ਹੈਲੋ ਸਤਿ ਸ਼੍ਰੀ ਅਕਾਲ ਮੈਮ ਰਜਿੰਦਰਾ ਹੋਸਪਿਟਲ ਤੋਂ ਬੋਲ ਰਹੇ ਹੋ ਮੈਮ ਓਕੇ ਮੈਮ ਮੈਂ ਨਾ ਐਂ ਜਾਣਨਾ ਸੀਗਾ ਵੀ ਇੱਥੇ ਰਜਿੰਦਰਾ 'ਚ ਕਿਹੜੀਆਂ ਕਿਹੜੀਆਂ ਹੈਲਥ ਫੈਸਲਿਟੀਜ ਦਿੱਤੀਆਂ ਜਾਂਦੀਆਂ ਨੇ ਓਕੇ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਮਤਲਬ ਬਿਲਕੁਲ ਬਿਲਕੁਲ ਵੀ ਕੋਈ ਚਾਰਜਿਜ ਨਹੀਂ ਹੈਗੇ ਓਕੇ ਓਕੇ ਓਕੇ ਮੈਮ ਤੁਸੀਂ ਕਿਸ ਡੀ ਤੁਸੀਂ ਕਿਸ ਡਿਪਾਰਟਮੈਂਟ ਤੋਂ ਬੋਲ ਰਹੇ ਓਂ ਓਕੇ ਓਕੇ ਹਾਂ ਠੀਕ ਹੈ ਮੈਮ ਮੈਡੀਸਨਸ ਵੀ ਫਰੀ ਮਿਲਦੀਆਂ ਨੇ ਹਾਂਜੀ ਹਾਂਜੀ ਓਕੇ ਹਾਂਜੀ ਓਕੇ ਓਕੇ ਮੈਮ ਓਕੇ ਮੈਮ ਥੈਂਕ ਯੂ ਥੈਂਕ ਯੂ ਮੈਮ